ਸਾਡੇ ਰੋਜ਼ਾਨਾ ਦੀ ਖੁਰਾਕ ਵਿੱਚ ਰੋਟੀ ਸਬਜ਼ੀ ਦਾਲ ਦੁੱਧ ਦਹੀਂ ਮੱਖਣ ਆਦਿ ਸ਼ਾਮਿਲ ਹੁੰਦੇ ਹਨ ਕਣਕ ਅਤੇ ਸਬਜ਼ੀਆਂ ਅਸੀਂ ਖੇਤਾਂ ਵਿੱਚ ਉਗਾਉਂਦੇ ਹਾਂ ਜੋ ਕਿ ਬਿਨਾਂ ਰੇਹ ਸਪਰੇਅ ਤੋਂ ਸਾਡੀ ਸਿਹਤ ਲਈ ਜ਼ਿਆਦਾ ਲਾਭਦਾਇਕ ਹੁੰਦੇ ਹਨ ਅਸੀਂ ਰੋਜ਼ਾਨਾ ਸਬਜ਼ੀਆਂ ਹਰੀਆਂ ਸਬਜ਼ੀਆਂ ਆਪੇ ਆਪਣੇ ਭੋਜਨ ਵਿੱਚ ਸ਼ਾਮਲ ਕਰਦੇ ਹਾਂ ਜਿਸ ਤੋਂ ਸਾਨੂੰ ਵਧੀਆ ਖੁਰਾਕ ਪ੍ਰਾਪਤ ਹੁੰਦੀ ਹੈ ਅਸੀਂ ਦੁਪਹਿਰ ਵੇਲੇ ਕਈ ਵਾਰ ਚਾਵਲ ਆਦਿ ਚਾਹ ਪਕੌੜੇ ਵਗੈਰਾ ਬਣਾ ਲੈਂਦੇ ਹਾਂ ਅਤੇ ਦੁੱਧ ਦਹੀਂ ਰਿੜਕ ਕੇ ਪੀ ਲੈਂਦੇ ਹਾਂ ਜੋ ਕਿ ਸਾਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ ਅਤੇ ਅਸੀਂ ਬਿਮਾਰੀਆਂ ਤੋਂ ਰਹਿਤ ਰਹਿੰਦੇ ਹਾਂ ਇਹ ਸਭ ਕੁਝ ਅਸੀਂ ਆਪਣੇ ਖੇਤਾਂ ਵਿੱਚ ਉਗਾਉਂਦੇ ਹਾਂ ਦਾਲਾਂ ਵੀ ਅਸੀਂ ਆਪਣੇ ਖੇਤਾਂ ਵਿੱਚ ਹੀ ਉਗਾ ਲੈਂਦੇ ਹਾਂ ਜੋ ਕਿ ਚੰਗੀ ਕੁਆਲਿਟੀ ਦੀਆਂ ਹੁੰਦੀਆਂ ਹਨ ਅਸੀਂ ਕਈ ਵਾਰ ਸਬਜ਼ੀ ਅਤੇ ਕਈ ਵਾਰ ਦਾਲ ਆਦਿ ਬਣਾਉਂਦੇ ਹਾਂ ਤਾਂ ਜੋ ਸਾਨੂੰ ਸਬਜ਼ੀਆਂ ਵਿੱਚੋਂ ਪੋਸ਼ਟਿਕ ਤੱਤ ਮਿਲਦੇ ਰਹਿਣ ਅਤੇ ਦਾਲਾਂ ਵਿੱਚੋਂ ਵੀ ਸਾਰੇ ਪੂਰੇ ਹੁੰਦੇ ਆ